ਹੈਲੋ ਹਾਂਜੀ ਤੁਸੀਂ ਓਲਾ ਕੈਬ ਤੋਂ ਬੋਲ ਰਹੇ ਓਂ ਹਾਂਜੀ ਅਸੀਂ ਇੱਕ ਓਲਾ ਕੈਬ ਬੁੱਕ ਕਰਨੀ ਸੀ ਤੇਰ੍ਹਾਂ ਜਨਵਰੀ ਦੀ ਲੋਹੜੀ ਵਾਲੇ ਦਿਨ ਦੀ ਸ਼ਾਮ ਨੂੰ ਛੇ ਵਜੇ ਅਸੀਂ ਜਾਣਾ ਹੈ ਕੋਹੇਨੂਰ ਪੈਲੇਸ ਦੇ ਵਿੱਚ ਜਿਹੜਾ ਕਿ ਰਾਜਪੁਰਾ ਰੋਡ 'ਤੇ ਪੈਂਦਾ ਆ ਅਤੇ ਸਾਨੂੰ ਤੁਸੀਂ ਪਿੱਕ ਕਰਨਾ ਹੋਏਗਾ ਖ਼ਾਲਸਾ ਕਲੋਨੀ 'ਚੋਂ ਸ਼ਾਮ ਦੇ ਛੇ ਵਜੇ ਹਾਂਜੀ ਠੀਕ ਹੈ ਜੀ ਫਿਰ ਤੁਸੀਂ ਖ਼ਰਚਾ ਅੰਦਾਜ਼ੇ ਮੁਤਾਬਕ ਖ਼ਰਚਾ ਦੱਸ ਦਿਉ ਸਾਨੂੰ ਠੀਕ ਹੈ ਹਾਂਜੀ ਹਾਂਜੀ ਖ਼ਾਲਸਾ ਕਲੋਨੀ ਤੋਂ ਸਾਨੂੰ ਪਿੱਕ ਕਰ ਲੈਣਾ ਤੁਸੀਂ ਛੇ ਵਜੇ